ਅੱਜ ਦਾ ਸਮਾਂ ਭੱਜ ਦੌੜ ਦਾ ਸਮਾਂ ਹੈ ਇਸਦੇ ਵਿੱਚ ਹਰ ਵਿਅਕਤੀ ਇੰਨਾਂ ਉਲਝਿਆ ਹੋਇਆ ਹੈ ਕਿ ਉਹ ਆਪਣੀ ਸਰੀਰਕ ਤਾਕਤ ਨੂੰ ਵਧਾਉਣਾ ਚਾਹੁੰਦਾ ਹੈ ਆਪਣੀ ਸਰੀਰਕ ਤੰਦਰੁਸਤੀ ਨੂੰ ਵਧਾਉਣਾ ਚਾਹੁੰਦਾ ਹੈ ਜਿਸ ਦੇ ਲਈ ਉਹ ਜਿਮ ਦੇ ਵਿੱਚ ਜਾਂਦੇ ਹਨ ਸਰੀਰਕ ਕਸਰਤਾਂ ਕਰਦੇ ਹਨ ਪਰ ਸਰੀਰਕ ਕਸਰਤ ਯੋਗ ਨਾਲੋਂ ਬਿਲਕੁਲ ਵੱਖਰੀ ਹੈ ਸਰੀਰਕ ਕਸਰਤ ਦੇ ਵਿੱਚ ਹਰ ਵਿਅਕਤੀ ਆਪਣੇ ਸਰੀਰ ਨੂੰ ਕਸ਼ਟ ਦਿੰਦਾ ਹੈ ਅਲੱਗ ਅਲੱਗ ਤਰ੍ਹਾਂ ਦੀਆਂ ਕਸਰਤਾਂ ਕਰਦਾ ਹੈ ਆਪਣੇ ਸਰੀਰ ਦੇ ਵਿੱਚੋਂ ਪਸੀਨਾ ਦੂਰ ਕਰਦਾ ਹੈ ਅਤੇ ਇੱਕ ਤਰ੍ਹਾਂ ਦੀ ਥਕਾਵਟ ਜਿਹੜੀ ਹੈ ਉਸ ਦੇ ਸਰੀਰ ਦੇ ਵਿੱਚ ਆ ਜਾਂਦੀ ਹੈ ਇਸ ਦੇ ਨਾਲ ਉਸਦੇ ਕੰਮ ਕਰਨ ਦੀ ਜਿਹੜੀ ਸਮਰੱਥਾ ਹੈ ਉਹ ਹੋਰ ਵੀ ਜ਼ਿਆਦਾ ਘੱਟ ਜਾਂਦੀ ਹੈ ਇਸ ਤਰ੍ਹਾਂ ਇੱਕ ਵਿਅਕਤੀ ਜਿਹੜਾ ਹੈ ਉਹ ਮਾਨਸਿਕ ਤੌਰ 'ਤੇ ਕਮਜ਼ੋਰ ਹੋ ਜਾਂਦਾ ਹੈ ਪਰ ਯੋਗ ਯੋਗ ਇੱਕ ਅਜਿਹਾ ਸਾਧਨ ਹੈ ਜਿਸ ਦੇ ਵਿੱਚ ਅਸੀਂ ਸਰੀਰਕ ਕਸਰਤ ਦੇ ਨਾਲ ਨਾਲ ਮਾਨਸਿਕ ਕਸਰਤ ਵੀ ਕਰਦੇ ਹਾਂ ਇਸ ਦੇ ਨਾਲ ਸਾਡੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ ਸਾਡੇ ਗੁੱਸੇ ਦੇ ਵੀ ਉੱਤੇ ਕੰਟਰੋਲ ਹੁੰਦਾ ਹੈ ਅੱਜ ਕੱਲ੍ਹ ਦੀ ਜੋ ਭੱਜ ਨੱਠ ਵਾਲੀ ਜ਼ਿੰਦਗੀ ਹੈ ਜਿਸ ਦੇ ਵਿੱਚ ਹਰ ਵਿਅਕਤੀ ਤਣਾਅ ਦੇ ਵਿੱਚ ਰਹਿੰਦਾ ਹੈ ਉਹ ਅਜਿਹੇ ਸਮੇਂ ਦੇ ਵਿੱਚ ਯੋਗ ਜੋ ਹੈ ਉਹ ਸਾਡੇ ਲਈ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ ਸਾਡੇ ਚਿੜਚਿੜੇਪਨ ਨੂੰ ਦੂਰ ਕਰਨ ਦੇ ਵਿੱਚ ਸਾਡੇ ਗੁੱਸੇ ਨੂੰ ਕੰਟਰੋਲ ਕਰਨ ਦੇ ਵਿੱਚ ਸਾਡੇ ਮਾਨਸਿਕ ਤੰਦਰੁਸਤੀ ਨੂੰ ਬਣਾਈ ਰੱਖਣ ਦੇ ਵਿੱਚ ਯੋਗ ਜੋ ਹੈ ਬਹੁਤ ਹੀ ਲਾਭਦਾਇਕ ਸਿੱਧ ਹੋ ਰਿਹਾ ਹੈ ਯੋਗ ਦੇ ਨਾਲ ਅਸੀਂ ਆਪਣੇ ਮਨ ਨੂੰ ਤੰਦਰੁਸਤ ਕਰ ਸਕਦੇ ਹਾਂ ਸਰੀਰਕ ਤੌਰ 'ਤੇ ਤਾਂ ਅਸੀਂ ਫਿੱਟ ਹੋ ਜਾਦੇ ਹਾਂ ਪਰ ਮਾਨਸਿਕ ਤੌਰ 'ਤੇ ਫਿੱਟ ਹੋਣ ਦੇ ਲਈ ਯੋਗ ਸਾਡੇ ਲਈ ਬਹੁਤ ਜ਼ਰੂਰੀ ਹੈ ਯੋਗ ਸਾਡੇ ਲਈ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ ਸਾਨੂੰ ਯੋਗ ਦੇ ਵਿੱਚ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਇਸ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਸਵਰਗ ਬਣਾ ਸਕਦੇ ਹਾਂ